ਜੇ ਆਪਾਂ ਲੋਕ ਨਾਚ ਦੀ ਗੱਲ ਕਰੀਏ ਤਾਂ ਇਸ ਵਿੱਚ ਬਹੁਤ ਸਾਰੇ ਨਾਚ ਆ ਜਾਂਦੇ ਹਨ ਜਿਵੇਂ ਭੰਗੜਾ ਲੁੱਡੀ ਮਲਵਈ ਗਿੱਧਾ ਆਦਿ ਪਰ ਸਾਡੇ ਪੰਜਾਬੀ ਮੁੰਡਿਆਂ ਨੂੰ ਪਿੰਡਾਂ ਦੀਆਂ ਬਹੁਤ ਖਾਸ ਕਰਕੇ ਭੰਗੜਾ ਪਾਉਣਾ ਪਸੰਦ ਹੈ ਪੰਜਾਬ ਦਾ ਭੰਗੜਾ ਦੁਨੀਆ ਭਰ ਵਿੱਚ ਬਹੁਤ ਪ੍ਰਸਿੱਧ ਹੈ ਭੰਗੜੇ ਪਾਉਣ ਦੇ ਸਮੇਂ ਵਿੱਚ ਦਸ ਤੋਂ ਬਾਰ੍ਹਾਂ ਮੁੰਡੇ ਨੌਜਵਾਨ ਪੰਜਾਬੀ ਗਾਣੇ 'ਤੇ ਆਪਣੀ ਪੇਸ਼ਕਾਰੀ ਕਰਦੇ ਹਨ ਉਹਨਾਂ ਦਾ ਪਹਿਰਾਵਾ ਕੁੜਤਾ ਚਾਦਰਾ ਹੁੰਦਾ ਹੈ ਗਲੇ ਵਿੱਚ ਕੈਂਠੇ ਪਾਏ ਹੁੰਦੇ ਹਨ ਅਤੇ ਹੱਥਾਂ ਵਿੱਚ ਖੁੰਡੀ ਫੜਦੇ ਹਨ ਅਤੇ ਪੈਰਾਂ ਵਿੱਚ ਪੰਜਾਬੀ ਜੁੱਤੀ ਪਾਉਂਦੇ ਹਨ ਉਹਨਾਂ ਦੇ ਪਹਿਰਾਵੇ ਦੇ ਨਾਲ ਨਾਚ ਹੋਰ ਵੀ ਵਧੀਆ ਨਿਕਲ ਕੇ ਆਉਂਦਾ ਹੈ